ਨਮਸਕਾਰ ਸਰ ਸਰ ਤੁਸੀਂ ਟਰੈਵਲ ਏਜੰਸੀ ਤੋਂ ਬੋਲਦੇ ਹੋ ਸਰ ਤੁਸੀਂ ਬੁਕਿੰਗ ਵਗੈਰਾ ਕਰਦੇ ਹੋ ਹੈ ਨਾ ਕੀ ਅ ਜਾਣ ਆਉਣ ਵਾਲੇ ਵਾਸਤੇ ਹਾਂਜੀ ਹਾਂਜੀ ਸਰ ਤੁਸੀਂ ਮਨਾਲੀ ਦਾ ਟੂਰ ਹਾਂਜੀ ਸਰ ਇੱਥੋਂ ਫਾਜ਼ਿਲਕਾ ਤੋਂ ਮਨਾਲੀ ਅਸੀਂ ਚੱਲੇ ਹਾਂ ਹੋਲੀਡੇ 'ਤੇ ਹਾਂਜੀ ਫੈਮਲੀ ਟੂਰ ਹੈ ਸਾਡਾ ਅਤੇ ਅਸੀਂ ਉੱਥੇ ਦਸ ਦਿਨ ਵਿਜਿਟ ਕਰਨਾ ਹਾਂਜੀ ਅਤੇ ਸਾਨੂੰ ਗੱਡੀ ਚਾਹੀਦੀ ਸੀਗੀ ਅਤੇ ਸਾਰੀ ਫੈਮਿਲੀ ਨੇ ਜਾਣਾ ਹੈ ਤੁਹਾਡੇ ਕੋਲੋਂ ਵਹੀਕਲ ਲੈਣਾ ਗੱਡੀ ਤੁਹਾਡੇ ਕੋਲ ਕਿਹੜੀ ਕਿਹੜੀ ਹੈਗੀ ਅਵੇਲੇਬਲ ਅੱਛਾ ਜੀ ਠੀਕ ਆ ਸਰਕਾਰਪਿਓ ਹੀ ਠੀਕ ਆ ਸਰ ਉੱਥੇ ਹੋਟਲ ਵਗੈਰਾ ਦਾ ਤੁਸੀਂ ਪ੍ਰਬੰਧ ਕਰ ਦੋਗੇ ਸਾਡਾ ਹਾਂਜੀ ਸਾਡੇ ਪੰਜ ਮੈਂਬਰ ਆ ਫੈਮਲੀ ਦੇ ਹਾਂਜੀ ਪੰਜ ਮੈਂਬਰਾਂ ਨੇ ਅਸੀਂ ਜਾਣਾ ਟੂਰ 'ਤੇ ਅਤੇ ਮਨਾਲੀ ਉੱਥੇ ਹੋਟਲ ਦਾ ਅਤੇ ਖਾਣ ਪੀਣ ਦਾ ਐਵੇਂ ਦਾ ਸਾਰਾ ਤੁਸੀਂ ਕਰ ਦੋਗੇ ਹਾਂਜੀ ਜੇ ਕੱਲ੍ਹ ਨੂੰ ਕੋਈ ਸਾਨੂੰ ਵਿੱਚ ਪਸੰਦ ਨਹੀਂ ਆਉਂਦਾ ਜਾਂ ਹੋਟਲ ਵਗੈਰਾ ਐਵੇਂ ਦਾ ਕੁਝ ਚੇਂਜ ਵਗੈਰਾ ਹੋ ਜੇਗਾ ਠੀਕ ਹੈ ਸਰ ਸਰ ਅਸੀਂ ਜਾਣਾ ਸੀਗਾ ਦਸੰਬਰ 'ਚ ਛੁੱਟੀ 'ਤੇ ਦਸੰਬਰ 'ਚ ਜਾਣਾ ਹਾਂਜੀ ਹਾਂਜੀ ਪੰਜ ਕੁ ਦਸੰਬਰ ਤੱਕ ਹੋਵੇਗਾ ਓਕੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਸਰ ਸਰ ਉਥੋਂ ਦੀ ਜਿੰਨੇ ਵੀ ਪਲੇਸਿਸ ਹੈਗੀਆਂ ਨੇ ਘੁੰਮਣ ਯੋਗ ਉਹ ਤਾਂ ਤੁਸੀਂ ਕਰਵਾ ਦੋਗੇ ਨਾ ਓਕੇ ਜੀ ਹਾਂਜੀ ਕਿਉਂਕਿ ਅਸੀਂ ਪਹਿਲੀ ਵਾਰ ਚੱਲੇ ਹਾਂ ਅਤੇ ਫਿਰ ਸਾਨੂੰ ਥੋੜ੍ਹਾ ਨਹੀਂ ਨੌਲੇਜ ਹੈਗੀ ਹਾਂਜੀ ਹਾਂਜੀ ਠੀਕ ਹੈ ਜੀ ਓਕੇ ਸਰ ਥੈਂਕ ਯੂ